ਹਾਂਜੀ ਮੇਰੇ ਕੋਲ ਕੁਛ ਕੁ ਮੇਰੀਆਂ ਪੁਰਾਣੀਆਂ ਫੋਟੋਆਂ ਦੀ ਹਾਰਡ ਕਾਪੀ ਵੀ ਹੈ ਪੁਰਾਣੀਆਂ ਫੋਟੋਆਂ ਅਤੇ ਨਵੀਆਂ ਫੋਟੋਆਂ ਦੇ ਵਿੱਚ ਇਹ ਹੀ ਫ਼ਰਕ ਹੁੰਦਾ ਹੈ ਕਿ ਇੱਕ ਵਾਰ ਜਦੋਂ ਆਪਾਂ ਨਵੀਂ ਫੋਟੋ ਖਿੱਚਦੇ ਹਾਂ ਉਦੋਂ ਤਾਂ ਆਪਾਂ ਨੂੰ ਇਹ ਲੱਗਦਾ ਹੈ ਕਿ ਬਸ ਇਕ ਨੋਰਮਲ ਫੋਟੋ ਹੈ ਬਟ ਕੁਛ ਕੁ ਫੋਟੋਆਂ ਆਪਣੀਆਂ ਇੱਦਾਂ ਦੀਆਂ ਹੁੰਦੀਆਂ ਜਦੋਂ ਉਹਨਾਂ ਨੂੰ ਕੁਝ ਕੁ ਟਾਈਮ ਹੋ ਜਾਂਦਾ ਖਿੱਚੀਆਂ ਨੂੰ ਤਾਂ ਉਹ ਆਪਣੀ ਇਹ ਭਾਵਨਾਤਮਕ ਮੁੱਲ ਆਪਣੇ 'ਚ ਕ੍ਰੀਏਟ ਕਰਦੀ ਹੈ ਜਿਵੇਂ ਕਿ ਅਸੀਂ ਆਪਣੀਆਂ ਮੈਮਰੀਜ਼ ਨੂੰ ਰੀਕੋਲੈਕਟ ਕਰਦੇ ਹੈ ਫਿਰ ਉਹਦੇ ਲਈ ਇਮੋਸ਼ਨਲ ਹੋ ਜਾਂਦੇ ਆ ਕਈ ਵਾਰ ਬਹੁਤ ਮਤਲਬ ਫੋਟੋਸ ਇੱਦਾਂ ਦੀਆਂ ਹੁੰਦੀਆਂ ਜਿਨਾਂ ਨੂੰ ਦੇਖ ਕੇ ਆਪਾਂ ਨੂੰ ਖੁਸ਼ੀ ਵੀ ਹੁੰਦੀ ਹੈ ਕਈ ਵਾਰ ਦੁੱਖ ਵੀ ਹੁੰਦਾ ਹੈ ਆਪਾਂ ਉਹ ਪਲਾਂ ਨੂੰ ਯਾਦ ਕਰਦੇ ਹਾਂ ਜਿਹੜੇ ਆਪਾਂ ਪਹਿਲਾਂ ਪਲ ਬਿਤਾਏ ਹੁੰਦੇ ਹੈ ਪੁਰਾਣੀਆਂ ਫੋਟੋਆਂ ਜੋ ਉਹ ਨਵੀਆਂ ਫੋਟੋਆਂ ਨਾਲੋਂ ਵਧੇਰੇ ਭਾਵਨਾਤਮਕ ਹੁੰਦੀਆਂ ਹੈ ਕਿਉਂਕਿ ਉਹਨਾਂ ਵਿੱਚ ਆਪਣੀਆਂ ਬਹੁਤ ਸਾਰੀਆਂ ਮੈਮਰੀਆਂ ਮੈਮਰੀਸ ਜੁੜੀਆਂ ਹੁੰਦੀਆਂ ਉਹਨਾਂ ਦੇ ਨਾਲ ਇਸ ਕਰਕੇ ਜੋ ਪੁਰਾਣੀਆਂ ਫੋਟੋਆਂ ਹੈ ਉਹਨਾਂ ਨੂੰ ਆਪਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਚਾਹੇ ਆਪਾਂ ਉਹਨਾਂ ਨੂੰ ਆਪਣੇ ਫੋਨ ਵਿੱਚ ਹੀ ਕਿਤੇ ਸੰਭਾਲ ਕੇ ਰੱਖੀਏ ਜਾਂ ਫਿਰ ਆਪਾਂ ਉਹਨਾਂ ਦੀ ਹਾਰਡ ਕਾਪੀ ਲੈ ਕੇ ਰੱਖੀਏ